ਮੈਂ ਰੋਪੜ ਦੇ ਵਿੱਚ ਰਹਿੰਦੀ ਹਨ ਇੱਥੇ ਬਹੁਤ ਸਾਰੇ ਸਿਆਸੀ ਸਮੂਹ ਜਾਂ ਸੰਗਠਨ ਹਨ ਜਿਵੇਂ ਕਿ ਖਾਲਸਾ ਸਮੂਹ ਸਿੰਘ ਸਮੂਹ ਆਦਿ ਇਹ ਬਹੁਤ ਸਾਰੇ ਟੂਰਨਾਮੈਂਟਸ ਕਰਵਾਉਂਦੇ ਹਨ ਜਿਵੇਂ ਕਿ ਹਾਕੀ ਦਾ ਕਬੱਡੀ ਆਦਿ ਹੋਰ ਵੀ ਕਈ ਗੇਮਾਂ ਲਗਾ ਸਕਦੇ ਹਨ ਅਸੀਂ ਜਿਵੇਂ ਕਿ ਫੁੱਟਬਾਲ ਬਾਸਕਿਟਬਾਲ ਆਦਿ ਦੇ ਇਹ ਟੂਰਨਾਮੈਂਟਸ ਦਾ ਪ੍ਰਬੰਧ ਕਰਵਾਉਂਦੇ ਹਨ ਅਤੇ ਇਹਨਾਂ ਦੇ ਕਰਵਾਏ ਗਏ ਪ੍ਰਬੰਧ ਬਹੁਤ ਹੀ ਵਧੀਆ ਹੁੰਦੇ ਹਨ ਜਿਸਦੇ ਵਿੱਚ ਸਾਰੇ ਖਿਡਾਰੀ ਵਧੀਆ ਤਰੀਕੇ ਨਾਲ ਬੁਲੰਦੀਆਂ ਹਾਸਲ ਕਰਦੇ ਹਨ ਅਤੇ ਜਿੱਤ ਪ੍ਰਾਪਤ ਕਰਕੇ ਆਉਂਦੇ ਹਨ